ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਲੋਕਾਂ ਨੂੰ ਕਲਾ ਅਤੇ ਸ਼ਿਲਪਕਾਰੀ ਵਿੱਚ ਸ਼ਾਮਿਲ ਹੋਣ ਵਿੱਚ ਕਈ ਤਰੀਕਿਆਂ ਨਾਲ ਮਦਦ ਕੀਤੀ ਹੈ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਨੇ ਕਲਾ ਦੇ ਪ੍ਰਚਾਰ ਲਈ ਇੱਕ ਗਲੋਬਲ ਪਲੇਟਫੋਮ ਪ੍ਰਦਾਨ ਕੀਤਾ ਹੈ ਕਲਾਕਾਰ ਆਪਣੇ ਕੰਮ ਨੂੰ ਦੁਨੀਆ ਭਰ ਦੇ ਦਸ਼ਕ ਦਰਸ਼ਕਾਂ ਨਾਲ ਸਾਂਝਾ ਕਰ ਸਕਦੇ ਹਨ ਫੇਸਬੁੱਕ ਇੰਸਟਾਗ੍ਰਾਮ ਯੂਟਿਊਬ ਅਤੇ ਪਿੰਨਟਰੱਸਟ ਵਰਗੇ ਪਲੇਟਫਾਰਮ ਕਲਾਕਾਰਾਂ ਨੂੰ ਆਪਣੀ ਪ੍ਰਦਰਸ਼ਿਤ ਕਰਨ ਲਈ ਅਤੇ ਵਿਅਕਤੀਆਂ ਨੂੰ ਕਲਾ ਅਤੇ ਸ਼ਿਲਪਕਾਰਾਂ ਸ਼ਿਲਪਕਾਰੀ ਦੇ ਵਿਭਿੰਨ ਰੂਪਾਂ ਦੇ ਨਾਲ ਜੁੜਨ ਦੇ ਮੌਕੇ ਦਿੰਦੇ ਹਨ ਦੂਜਾ ਸੋਸ਼ਲ ਮੀਡੀਆ ਨੇ ਕਲਾ ਅਤੇ ਸ਼ਿਲਪਕਾਰੀ ਦੇ ਖੇਤਰ ਵਿੱਚ ਸਿੱਖਣ ਅਤੇ ਸਿਖਾਉਣ ਦੀ ਸਹੂਲੀਅਤ ਸਹੂਲਤ ਮੁਹੱਈਆ ਕਰਵਾਈ ਹੈ ਕਈ ਕਲਾਕਾਰ ਅਤੇ ਸ਼ਿਲਪਕਾਰ ਯੂਟਿਊਬ 'ਤੇ ਸਿੱਖਣ ਦੇ ਚੈਨਲ ਚਲਾਉਂਦੇ ਹਨ ਜਿੱਥੇ ਉਹ ਵੱਖ ਵੱਖ ਕਲਾ ਅਤੇ ਸ਼ਿਲਪ ਦੇ ਤਰੀਕਿਆਂ ਬਾਰੇ ਟਟੋਰਲ ਵੀਡੀਓ ਸਾਂਝੀਆਂ ਕਰਦੇ ਹਨ ਇਸ ਨਾਲ ਨਵੇਂ ਸਿਖਾਉਣ ਵਾਲੇ ਵਿਅਕਤੀਆਂ ਨੂੰ ਉਦੇਸ਼ਾ ਤੋਂ ਸਿੱਖਣ ਦਾ ਮੌਕਾ ਮਿਲਦਾ ਹੈ ਤੀਜਾ ਸੋਸ਼ਲ ਮੀਡੀਆ ਨੇ ਕਲਾ ਅਤੇ ਸ਼ਿਲਪਕਾਰਾਂ ਨੂੰ ਦੁਨੀਆਂ ਭਰ ਦੀ ਭਾਈਚਾਰਕ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਹੈ ਕਲਾ ਅਤੇ ਸ਼ਿਲਪਕਾਰ ਸ਼ਾਮਿਲ ਹੋ ਸਕਦੇ ਹਨ ਅਤੇ ਆਪਣੀਆਂ ਸੋਚਾਂ ਅਤੇ ਆਈਡੀਆਸ ਸਾਂਝੇ ਕਰ ਸਕਦੇ ਹਨ ਇਹ ਸੰਪਰਕ ਕਲਾ ਦੇ ਖੇਤਰ ਵਿੱਚ ਨਵੇਂ ਸਾਥ ਅਤੇ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਉਭਾਰ ਸਕਦੇ ਹਨ ਲੇਡੀਜ਼ ਜੋ ਕਿ ਘਰ ਫਰੀ ਹੁੰਦੀਆਂ ਹਨ ਆਪਣੇ ਘਰ ਦੇ ਡੇਲੀ ਦੇ ਕੰਮ ਕਰਕੇ ਉਹ ਯੂਟਿਊਬ ਤੋਂ ਹ ਬਹੁਤ ਕੁਛ ਸਿੱਖ ਸਕਦੀਆਂ ਹਨ ਅਤੇ ਆਪਣੀ ਕਲਾ ਨੂੰ ਨਿਖਾਰ ਸਕਦੀਆਂ ਹਨ ਚੌਥਾ ਸੋਸ਼ਲ ਮੀਡੀਆ ਨੇ ਕਲਾ ਅਤੇ ਸ਼ਿਲਪ ਦੇ ਪੈਸੇ ਕਮਾਉਣ ਦੇ ਮੌਕਿਆਂ ਨੂੰ ਵਧਾਇਆ ਹੈ ਕਈ ਕਲਾਕਾਰ ਅਤੇ ਸ਼ਿਲਪਕਾਰ ਆਪਣੇ ਕੰਮ ਨੂੰ ਵਿਕਣ ਲਈ ਔਨਲਾਈਨ ਸਟੋਰ ਖੋਲ੍ਹਦੇ ਹਨ ਜਿੱਥੇ ਉਹ ਆਪਣੀ ਨੂੰ ਵੇਚਦੇ ਹਨ ਇਹ ਕੁਛ ਯੂਟਿਊਬ ਚੈਨਲਸ ਵੀ ਹਨ ਜੋ ਕਿ ਇਹ ਕੰਮ ਨੂੰ ਸਿਖਾਉਂਦੇ ਹਨ ਜਿਵੇਂ ਕਿ ਟੋਨੀ ਆਟ ਐਂਡ ਕਰਾਫਟ ਡੀ ਆਈ ਵਾਈ ਗਿਫਟ ਆਈਡੀਆਸ ਇਹਨਾਂ ਵਿੱਚ ਬਹੁਤ ਹੀ ਕੁਛ ਸਿਖਾਇਆ ਜਾਂਦਾ ਹੈ ਮੈਂ ਅ ਬਹੁਤ ਸਾਰੇ ਤਰੀਕੇ ਦੱਸੇ ਜਾਂਦੇ ਹਨ ਅਤੇ ਦੱਸਿਆ ਜਾਂਦਾ ਹੈ ਕਿ ਕਿਵੇਂ ਕਿਵੇਂ ਆਪਾਂ ਆਪਣੀ ਕਲਾ ਨੂੰ ਨਿਖਾਰ ਸਕਦੇ ਹਾਂ ਕਿਵੇਂ ਆਪਾਂ ਇੱਕ ਅਗਰ ਆਪਾਂ ਕੋਈ ਤੋਹਫ਼ਾ ਪੈਕ ਕਰਨਾ ਹੈ ਤਾਂ ਉਸ ਨੂੰ ਕਿਵੇਂ ਵਧੀਆ ਢੰਗ ਨਾਲ ਪੈਕ ਕਰ ਸਕਦੇ ਹਾਂ ਇਸ 'ਚ ਬੁਣਤੀ ਸਿਖਾਈ ਜਾਂਦੀ ਹੈ ਅਤੇ ਅਖ਼ਬਾਰ ਜੋ ਕਿ ਆਪਾਂ ਰੱਦੀ ਵਿੱਚ ਵੇਚਦੇ ਹਾਂ ਉਹਨਾਂ ਬਾਰੇ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ਹੋਰ ਵੀ ਬਹੁਤ ਕੁਛ ਸਿਖਾਇਆ ਜਾਂਦਾ ਹੈ ਯੂਟੀਊਬ ਤੋਂ ਜਿਸ ਦੇ ਨਾਲ ਕੋਈ ਵਿਅਕਤੀ ਆਪਣੀ ਕਲਾ ਨੂੰ ਨਿਖਾਰ ਸਕਦੇ ਹਨ ਸੋਸ਼ਲ ਮੀਡਿਆ ਨੇ ਕਲਾਕਾਰ ਅਤੇ ਸ਼ਿਲਪਕਾਰੀ ਦੇ ਖੇਤਰ ਵਿੱਚ ਕਾਫ਼ੀ ਵਾਧਾ ਕੀਤਾ ਹੈ ਇਸ ਨੇ ਲੋਕਾਂ ਨੂੰ ਇਹ ਕਲਾ ਦੇ ਤਜਰਬੇ ਤਜਰਬੇ ਨੂੰ ਵਧਾਉਣ ਸਿੱਖਿਆ ਅਤੇ ਸਿਖਾਉਣ ਅਤੇ ਕੰਮ ਨੂੰ ਦੂਜਿਆ ਨਾਲ ਸਹਾਇਤਾ ਕਰਨ ਦੇ ਮੌਕੇ ਦਿੱਤੇ ਹਨ